ਤੇਰਾਂ ਅਪ੍ਰੈਲ ਚੌਦਾਂ ਸੌ ਉਣੱਤਰ ਛੇ ਜੂਨ ਉੱਨੀ ਸੌ ਚੁਰਾਸੀ ਪੰਦਰਾਂ ਅਗਸਤ ਦੋ ਹਜ਼ਾਰ ਪੰਦਰਾਂ ਪੰਦਰਾਂ ਮਾਰਚ ਦੋ ਹਜ਼ਾਰ ਉੱਨੀ ਉੱਨੀ ਅਪ੍ਰੈਲ ਉੱਨੀ ਸੌ ਨੜਿਨਵੇਂ